ਪੰਜਾਬ ਦੀ ਵੰਡ ਦੇ ਦੌਰਾਨ ਗੱਲ ਕਰੀਏ ਤਾਂ ਪੰਜਾਬ ਦੇ ਆਰਥਿਕ ਪ੍ਰਭਾਵ ਸਮਾਜਿਕ ਪ੍ਰਭਾਵ ਅਤੇ ਰਾਜਨੀਤਿਕ ਪ੍ਰਭਾਵ ਪਏ ਜਿਹਨਾਂ ਦੇ ਵਿੱਚ ਆਰਥਿਕ ਪ੍ਰਭਾਵ ਨੇ ਬਹੁਤ ਹੀ ਜ਼ਿਆਦਾ ਨੁਕਸਾਨ ਕੀਤਾ ਜਿਵੇਂ ਕਿ ਸਾਧਨਾਂ ਦੀ ਘਾਟ ਵੰਡ ਦੇ ਦੌਰਾਨ ਬਹੁਤ ਸਾਰੇ ਆਰਥਿਕ ਸਾਧਨ ਅਤੇ ਜਾਇਦਾਦਾਂ ਦਾ ਵਿਭਾਜਨ ਹੋਇਆ ਘਾਟ ਹੋ ਗਈ ਜਿਸ ਦੇ ਨਾਲ ਖ਼ਾਸ ਕਰਕੇ ਕਿਸਾਨਾਂ ਅਤੇ ਉਦਯੋਗਿਕ ਖੇਤਰਾਂ ਵਿੱਚ ਕਮਜ਼ੋਰੀ ਆ ਗਈ ਜਿਸ ਨਾਲ ਬਹੁਤ ਹੀ ਮੁਸ਼ਕਿਲ ਵਾਲੀ ਸਥਿਤੀ ਪੈਦਾ ਹੋ ਗਈ ਇਸ ਤੋਂ ਬਿਨਾਂ ਮੁਲਕੀ ਸਮੱਸਿਆ ਜਿਵੇਂ ਕਿ ਨਵੇਂ ਨਵੇਂ ਦੇਸ਼ ਭਾਰਤ ਪਾਕਿਸਤਾਨ ਨੇ ਸਰਕਾਰੀਆਂ ਅਤੇ ਸੰਗਠਨਾਤਮਕ ਢਾਂਚਿਆਂ ਨੂੰ ਸਥਾਪਿਤ ਕਰਨ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇਹਨਾਂ ਤੋਂ ਬਿਨਾਂ ਵੀਜ਼ੇ ਦੇ ਪ੍ਰਭਾਵ ਮਤਲਬ ਬਹੁਤ ਸਾਰੇ ਲੋਕਾਂ ਨੂੰ ਆਪਣੇ ਘਰਾਂ ਅਤੇ ਮੁਲਕਾਂ ਤੋਂ ਭੱਜਣਾ ਪਿਆ ਜਿਸ ਨਾਲ ਉਹਨਾਂ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਨੂੰ ਬਹੁਤ ਪ੍ਰਭਾਵਿਤ ਕੀਤਾ ਗਿਆ ਜਿਸ ਨਾਲ ਉਹਨਾਂ ਦਾ ਰਹਿਣਾ ਸਹਿਣਾ ਵਿੱਚ ਵੀ ਬਹੁਤ ਪਰਿਵਰਤਨ ਹੋਇਆ ਵੋ ਹੋਰ ਵੀ ਬਹੁਤ ਸਮੱਸਿਆ ਦਾ ਜੋ ਕਿ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਔਰ ਜੇ ਇਹਨਾਂ ਦੇ ਸੁਧਾਰ ਦੀ ਗੱਲ ਕਰੀਏ ਤਾਂ ਇਸ ਵਿੱਚ ਸਰਕਾਰ ਦੀਆਂ ਨੀਤੀਆਂ ਬਹੁਤ ਬਣਾਈਆਂ ਗਈਆਂ ਜਿਵੇਂ ਕਿ ਭਾਰਤ ਨੇ ਉੱਨੀ ਸੌ ਪੰਜਾਹ ਦੇ ਦਹਾਕੇ ਵਿੱਚ ਆਰਥਿਕ ਵਿਕਾਸ ਦੇ ਲਈ ਕਈ ਯੋਜਨਾਵਾਂ ਲਾਗੂ ਕੀਤੀਆਂ ਜਿਹਨਾਂ ਵਿੱਚ ਪੰਜ ਵਰੇ ਦੀ ਯੋਜਨਾ ਵੀ ਸੀ ਜਿਸ ਨੇ ਬਹੁਤ ਜਿਆਦਾ ਵਿਕਾਸ ਕੀਤਾ ਅਤੇ ਸੁਧਾਰ ਕੀਤਾ ਉਦਯੋਗਿਕਤਾ ਨੂੰ ਧਿਆਨ ਵਿੱਚ ਰੱਖ ਕੇ ਸੁਧਾਰ ਹੋਏ ਨਵੇਂ ਉਦਯੋਗਿਕ ਨੀਤੀਆਂ ਦੇ ਨਾਲ ਦੇਸ਼ ਨੇ ਭਾਰਤੀ ਉਦਯੋਗਿਕਤਾ ਨੂੰ ਉਤਸ਼ਾਹਿਤ ਕੀਤਾ ਜਿਸ ਨਾਲ ਨੌਕਰੀਆਂ ਵਿੱਚ ਵਾਧਾ ਹੋਇਆ ਰੁਜ਼ਗਾਰ ਪ੍ਰਾਪਤ ਹੋਇਆ ਅਤੇ ਰਾਸ਼ਟਰੀ ਆਮਦਨ ਅਤੇ ਆਮਦਨ ਦੇ ਵਿੱਚ ਵਾਧਾ ਹੋਇਆ ਅਤੇ ਆਰਥਿਕਤਾ ਵਿੱਚ ਵੀ ਸੁਧਾਰ ਹੋਇਆ ਇਸ ਤੋਂ ਬਿਨਾਂ ਖੇਤੀਬਾੜੀ ਵਿੱਚ ਵੀ ਸੁਧਾਰ ਕੀਤੇ ਗਏ ਜਿਵੇਂ ਕਿ ਜਮੀਨ ਦੇ ਸੰਸਾਧਨਾਂ ਦੀ ਬਿਹਤਰ ਵਰਤੋਂ ਹੋਣ ਲੱਗ ਗਈ ਨਵੀਨਤਮ ਤਕਨੀਕਾਂ ਆਉਣ ਲੱਗ ਗਈਆਂ ਸਰਕਾਰੀ ਸਮਰਥਨ ਨੇ ਵੀ ਖੇਤੀਬਾੜੀ ਵਿੱਚ ਵਾਧਾ ਕੀਤਾ ਭਾਰਤ ਦਾ ਵਿਕਾਸ ਕਿਵੇਂ ਹੋਇਆ ਸਮਾਜਿਕ ਨਿਰਮਾਣ ਮਤਲਬ ਸਿੱਖਿਆ ਸਿਹਤ ਅਤੇ ਆਰਥਿਕ ਖੇਤਰਾਂ ਵਿੱਚ ਸੁਧਾਰ ਲਿਆ ਕੇ ਭਾਰਤ ਨੇ ਆਪਣੇ ਲੋਕਾਂ ਦੀ ਜੀਵਨ ਸ਼ੈਲੀ ਨੂੰ ਬਹੁਤ ਹੀ ਬਿਹਤਰ ਬਣਾ ਲਿਆ ਗਿਆ ਆਰਥਿਕ ਖੋਲ੍ਹਣਾ ਨਾਲ ਮਤਲਬ ਉੱਨੀ ਸੌ ਇਕਾਨਵੇਂ ਵਿੱਚ ਆਰਥਿਕ ਨਾਲ ਭਾਰਤ ਨੇ ਵਿਦੇਸ਼ੀ ਨਿਵੇਸ਼ ਅਤੇ ਵਪਾਰ ਨੂੰ ਆਸਾਨ ਕੀਤਾ ਜਿਸ ਨਾਲ ਭਾਰਤ ਦੀ ਆਰਥਿਕਤਾ ਨਾਲ ਤੀਜੀ ਨਾਲ ਵਧੀਆ ਅਤੇ ਰਾਸ਼ਟਰੀ ਆਮਦਨ ਵਿੱਚ ਵੀ ਵਾਧਾ ਹੋਇਆ ਤਕਨੀਕੀ ਵਿਕਾਸ ਹੋਣ ਲੱਗ ਗਏ ਆਈ ਟੀ ਆਈ ਅਤੇ ਸੇਵਾ ਦੇ ਖੇਤਰਾਂ ਵਿੱਚ ਵਧੇਰੇ ਨਿਵੇਸ਼ ਨਾਲ ਭਾਰਤ ਨੇ ਗਲੋਬਲ ਮਾਰਕੀਟ ਵਿੱਚ ਆਪਣਾ ਸਥਾਨ ਬਹੁਤ ਵੱਡਾ ਬਣਾ ਲਿਆ ਸੀ ਸਥਿਤੀ ਨੂੰ ਸੰਭਾਲਿਆ ਗਿਆ ਉਸ ਟਾਈਮ ਆਰਥਿਕ ਰੂਪਾਂਤਰ ਮਤਲਬ ਭਾਰਤ ਨੇ ਬਹੁਤ ਸਾਰੇ ਨਵੇਂ ਉਦਯੋਗਾਂ ਅਤੇ ਕਾਰੋਬਾਰ ਵਿਕਸਿਤ ਕੀਤੇ ਜਿਸ ਨਾਲ ਰੁਜ਼ਗਾਰ ਦੇ ਨਵੇਂ ਨਵੇਂ ਮੌਕੇ ਬਣੇ ਅਤੇ ਰੁਜ਼ਗਾਰ ਪ੍ਰਾਪਤ ਹੋਇਆ ਸੰਕਟ ਸਮੇਂ ਮਾਰਗਦਰਸ਼ਨ ਹੋਏ ਮਤਲਬ ਦੋ ਹਜ਼ਾਰ ਅੱਠ ਦੇ ਵਿੱਚ ਆਰਥਿਕ ਸੰਕਟ ਦੇ ਦੌਰਾਨ ਭਾਰਤ ਨੇ ਤਕਨੀਕੀ ਅਤੇ ਆਰਥਿਕ ਨੀਤੀਆਂ ਨੂੰ ਲਾਗੂ ਕਰਕੇ ਆਪਣੇ ਆਪ ਨੂੰ ਬਚਾ ਲਿਆ ਇਸ ਤਰ੍ਹਾਂ ਭਾਰਤ ਨੇ ਪੰਜਾਬ ਦੀ ਵੰਡ ਦੇ ਦੌਰਾਨ ਆਰਥਿਕ ਭਾਵਾਂ ਪ੍ਰਭਾਵਾਂ ਨੂੰ ਸੰਭਾਲ ਕੇ ਵਕਤ ਵਕਤ 'ਤੇ ਨਵੀਆਂ ਨੀਤੀਆਂ ਲਾਗੂ ਕਰਕੇ ਆਪਣੇ ਆਪ ਨੂੰ ਦੁਬਾਰਾ ਬਣਾ ਲਿਆ ਅਤੇ ਇਸ ਤੋਂ ਬਿਨਾਂ ਹੋਰ ਅੱਗੇ ਗੱਲ ਕਰੀਏ ਤਾਂ ਪੰਜਾਬ ਦੀ ਵੰਡ ਦੇ ਵਿੱਚ ਮਹਿੰਗਾਈ ਬਹੁਤ ਵੱਧ ਗਈ ਸੀ ਮਤਲਬ ਮਹਿੰਗਾ ਵੰਡ ਦੇ ਨਾਲ ਨਾਲ ਆਰਥਿਕ ਦੇ ਕਾਰਨ ਮਹਿੰਗਾਈ ਵਿੱਚ ਵਾਧਾ ਹੋਇਆ ਜਿਸ ਨੇ ਲੋਕਾਂ ਦੇ ਜੀਵਨ ਪੱਧਰ 'ਤੇ ਬਹੁਤ ਹੀ ਮਾੜਾ ਪ੍ਰਭਾਵ ਪਾਇਆ ਜ਼ਰੂਰੀ ਸਮਾਨਾਂ ਦੀ ਕੀਮਤ ਵੱਧ ਗਈ ਜਿਸ ਨਾਲ ਘਰੇਲੂ ਖਰਚੇ 'ਤੇ ਬਹੁਤ ਹੀ ਜ਼ਿਆਦਾ ਬੋਝ ਪਿਆ ਬੇਰੁਜ਼ਗਾਰੀ ਵੱਧ ਗਈ ਬਹੁਤ ਸਾਰੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਕੰਮਕਾਜ ਦੇ ਸਥਾਨਾਂ ਨੂੰ ਛੱਡ ਕੇ ਭੱਜਣਾ ਪਿਆ ਜਿਸ ਨਾਲ ਬਜ਼ ਬੇਰੁਜ਼ਗਾਰੀ ਦੀ ਸਥਿਤੀ ਸਾਹਮਣੇ ਆਈ ਅਤੇ ਬਹੁਤ ਹੀ ਮਾੜੀ ਹਾਲਤ ਹੋ ਗਈ ਇਸ ਲਈ ਨਵੇਂ ਨਵੇਂ ਦੇੇਸ਼ਾਂ ਵਿੱਚ ਨੌਕਰੀਆਂ ਦੀ ਵੀ ਘਾਟ ਹੋ ਗਈ ਸੀ ਹੌਲੀ ਹੌਲੀ ਸੁਧਾਰ ਦੇ ਵਿੱਚ ਨਵੀਆਂ ਨੀਤੀਆਂ ਬਣਾਈਆਂ ਗਈਆਂ ਜਿਵੇਂ ਕਿ ਉੱਨੀ ਸੌ ਸੱਠ ਦੇ ਦਹਾਕੇ ਦੇ ਵਿੱਚ ਭਾਰਤ ਨੇ ਮਾਹੌਲ ਦੇ ਜੀਵਨ ਜਮੀਨੀ ਸੁਧਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਖੇਤੀਬਾੜੀ ਨੀਤੀ ਦੇ ਸੂਤਰਾਂ ਨੂੰ ਲਾਗੂ ਕੀਤਾ ਜਿਸ ਨਾਲ ਉਦਯੋਗਾਂ ਨੂੰ ਸਮਰਥਨ ਮਿਲਿਆ ਜਾਤੀ ਪ੍ਰਣਾਲੀ ਵਿੱਚ ਸੁਧਾਰ ਹੋਇਆ ਸਮਾਜਿਕ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਵਿਕਾਸ ਕਾਰਜਾਂ ਜਾਤੀਆਂ ਦੇ ਆਧਾਰ 'ਤੇ ਕੀਤਾ ਜਿਸ ਨਾਲ ਅਨਪੜ੍ਹ ਅਤੇ ਵਿਰੋਧੀ ਵਰਗਾਂ ਨੂੰ ਵੀ ਫਾਇਦਾ ਹੋਇਆ ਭਾਰਤ ਦੇ ਵਿੱਚ ਕੀ ਵਿਕਾਸ ਹੋਇਆ ਆਧੁਨਿਕਤਾ ਮਤਲਬ ਟੈਕਨੋਲਜੀ ਅਤੇ ਸਿੱਖਿਆ ਅਤੇ ਸਿਹਤ ਖੇਤਰਾਂ ਵਿੱਚ ਹੋਏ ਸੁਧਾਰਾਂ ਨੇ ਆਰਥਿਕ ਭਾਰਤ ਦੀ ਇਹ ਬਣਤਰ ਵਿੱਚ ਸਹਾਇਤਾ ਕੀਤੀ ਆਈ ਟੀ ਆਈ ਖੇਤਰਾਂ ਨੇ ਬਹੁਤ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ ਸਥਿਤੀ ਸੰਭਾਲੀ ਲਈ ਕਿਵੇਂ ਆ ਮਤਲਬ ਭਾਰਤ ਨੇ ਕਈ ਸਮਾਜਿਕ ਯੋਜਨਾਵਾਂ ਲਾਗੂ ਕੀਤੀਆਂ ਜਿਹਨਾਂ ਨੇ ਬਹੁਤ ਜ਼ਿਆਦਾ ਸਹਾਇਤਾ ਕੀਤੀ ਕਿਸਾਨ ਨੀਤੀਆਂ ਬਣਾਈਆਂ ਗਈਆਂ ਖੇਤੀਬਾਰੀ ਖੇਤਰਾਂ ਵਿੱਚ ਸੁਧਾਰ ਕਰਕੇ ਕਿਸਾਨਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰ ਦਿੱਤਾ ਅਤੇ ਪੇਂਡੂ ਦੇ ਪਿੰਡਾਂ ਵਿੱਚ ਵੀ ਪੇਂਡੂ ਵਿਕਾਸ ਹੋਇਆ